ਪੰਜਾਬ ਵਿੱਚ ਮੀਡੀਆ ਦੁਆਰਾ ਕਵਰ ਕੀਤੇ ਮੁੱਖ ਖ਼ਬਰਾਂ ਦੇ ਵਿਸ਼ੇ ਗੱਲਬਾਤ ਕਰਨ ਦਾ ਧੰਨਵਾਦ ਮੁੱਖ ਖ਼ਬਰਾਂ ਵਿੱਚ ਸਮਾਜ ਰਾਜਨੀਤੀ ਸਾਹਿਤ ਖੇਡ ਅਤੇ ਕੱਚੀ ਤਸਮਿ ਟੀ ਦੀਆਂ ਸਥਿੱਤੀਆਂ ਨੂੰ ਸੋਧਿਆ ਜਾਂਦਾ ਹੈ ਮੁੱਖ ਖ਼ਬਰਾਂ ਵਿੱਚ ਪੰਜਾਬੀ ਸਮਾਜ ਦੇ ਮੁੱਦੇ ਸਰਕਾਰੀ ਨੀਤੀਆਂ ਵਿੱਚ ਵਿਪਰੀਤ ਪੱਧਰਾਂ ਦੀ ਵਿਸ਼ਲੇਸ਼ਣ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸਾਥ ਹੀ ਸਹਿਤ ਅਤੇ ਕਲਾ ਦੇ ਕਾਰਗਰ ਸੰਦੇਸ਼ ਨੂੰ ਵੀ ਮੀਡੀਆ ਵਿੱਚ ਪ੍ਰਸ਼ਾਸ਼ਿਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਮੀਡੀਆ ਪੰਜਾਬ ਸਮਾਜ ਨੂੰ ਵਿਸ਼ੇਸ਼ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਲੋਕਾਂ ਨੂੰ ਜਾਣਕਾਰੀ ਦਿੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਅਤੇ ਕਿਵੇਂ ਉਹ ਉਹਨਾਂ ਦੇ ਸਮੂਹ ਸਮੁੱਚੇ ਪਰਿਵਾਰ ਦੀ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ